ਵੈਸੇ ਤਾਂ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਅਜਿਹੇ ਸਮਾਜਿਕ ਮੁੱਦੇ ਹਨ ਜਿਹਨਾਂ 'ਤੇ ਆਪਾਂ ਗੱਲ ਕਰ ਸਕਦੇ ਹਾਂ ਪਰ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਐਜੂਕੇਸ਼ਨ ਸਿਸਟਮ ਗਰੀਬੀ ਅਤੇ ਬੇਰੁਜ਼ਗਾਰੀ ਦਾ ਹੈ ਅਤੇ ਓਸ ਤੋਂ ਵੱਧ ਲਗਾ ਲਉ ਨਸ਼ਿਆਂ ਦਾ ਸ ਇੱਥੇ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਪਰ ਹਾਂ ਇਹ ਬੇਰੁਜ਼ਗਾਰੀ ਘੱਟ ਵੀ ਹੋ ਸਕਦੀ ਹੈ ਜੇ ਸਰਕਾਰ ਹਰੇਕ ਘਰ ਦੇ ਵਿੱਚ ਘੱਟੋ ਘੱਟ ਇੱਕ ਮੈਂਬਰ ਨੂੰ ਨੌਕਰੀ ਦੇਵੇ ਤਾਂ ਇਸ ਨਾਲ ਬੇਰੁਜ਼ਗਾਰੀ ਦਾ ਇਹ ਮਸਲਾ ਹੱਲ ਹੋ ਸਕਦਾ ਹੈ ਅਤੇ ਦੂਜੀ ਗੱਲ ਰਹੀ ਗਰੀਬੀ ਦੀ ਜੇ ਹਰੇਕ ਘਰ ਵਿੱਚ ਇੱਕ ਬੰਦੇ ਕੋਲ ਨੋਕਰੀ ਹੋਵੇਗੀ ਤਾਂ ਆਪਣੇ ਆਪ ਹੀ ਗਰੀਬੀ ਦੂਰ ਹੋਵੇਗੀ ਚਾਹੇ ਉਹ ਮਹੀਨੇ ਦਾ ਪੰਦਰਾਂ ਸੌ ਕਮਾਵੇ ਚਾਹੇ ਪੰਦਰਾਂ ਹਜ਼ਾਰ ਪਰ ਘੱਟੋ ਘੱਟ ਇੰਨੀ ਕੁ ਗਰੀਬੀ ਤਾਂ ਦੂਰ ਕਰ ਸਕਦੇ ਹਾਂ ਕਿ ਕੋਈ ਦੋ ਟੈਮ ਦੀ ਰੋਟੀ ਨਸੀਬ ਕਰ ਸਕੇ ਓਸ ਤੋਂ ਬਾਅਦ ਸਾਡੇ ਪੰਜਾਬ ਦੀ ਮੇਨ ਗੱਲ ਐਜੂਕੇਸ਼ਨ ਸਿਸਟਮ ਪੰਜਾਬ 'ਚ ਬਹੁਤ ਵੱਡੇ ਵੱਡੇ ਕੌਨਵੈਂਟ ਸਕੂਲ ਨੇ ਜਿਹੜੇ ਮੋਟੀਆਂ ਮੋਟੀਆਂ ਫੀਸਾਂ ਤਾਂ ਲੈਂਦੇ ਨੇ ਪਰ ਸਿਰਫ਼ ਇੰਗਲਿਸ਼ ਸਿਖਾਉਣ 'ਤੇ ਉਹਨਾਂ ਸਕੂਲਾਂ ਵਿੱਚ ਪੰਜਾਬੀ ਬੋਲਣਾ ਤਾਂ ਬੈਨ ਹੀ ਹੈ ਓਹਨਾਂ ਸਾਹਮਣੇ ਜੇ ਕੋਈ ਪੰਜਾਬੀ ਬੋਲੇ ਤਾਂ ਓਹ ਸੋਚਦੇ ਨੇ ਕਿ ਇਹ ਤਾਂ ਗੁਨਾਹ ਹੀ ਕਰ ਦਿੱਤਾ ਕਈਆਂ ਸਕੂਲਾਂ ਵਿੱਚ ਤਾਂ ਦਸ ਰੁਪਏ ਤੋਂ ਲੈ ਕੇ ਪੰਜ ਸੌ ਪੰਜ ਸੌ ਰੁਪਏ ਤੱਕ ਦਾ ਫਾਈਨ ਹੈ ਪੰਜਾਬੀ ਬੋਲਣ 'ਤੇ ਸਰਕਾਰ ਨੂੰ ਇਹ ਵੀ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚੋਂ ਸਕੂਲ ਹੁੰਦਿਆਂਂ ਉੱਥੇ ਆਪਦੇ ਬੱਚੇ ਪੰਜਾਬੀ ਨਹੀਂ ਬੋਲ ਸਕਦੇ ਇਹ ਤਾਂ ਕਿਸੇ ਮਾਣ ਵਾਲੀ ਗੱਲ ਦਾ ਉਹ ਨਾ ਨਾ ਹੋਇਆ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਹਾਂ ਇਸ ਪੰਜਾਬੀ ਭਾਸ਼ਾ ਲਈ ਤਾਂ ਸਾਡੀ ਕੌਮ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਜਾ ਕੇ ਸਾਨੂੰ ਇਹ ਆਜ਼ਾਦੀ ਮਿਲੀ ਤਾਂ ਫਿਰ ਵੀ ਪੰਜਾਬ 'ਚ ਰਹਿੰਦਿਆਂ ਕੋਨਵੈਂਟਾਂ ਸਕੂਲ ਦੇ ਇਹ ਰੂਲ ਨੇ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਹਟਾ ਕੇ ਇੰਗਲਿਸ਼ ਅਤੇ ਹੋਰ ਭਾਸ਼ਾਵਾਂ ਵੱਲ ਕਰ ਦਿੱਤਾ ਅਸੀਂ ਇਹ ਨਹੀਂ ਕਹਿੰਦੇ ਕਿ ਬਾਕੀ ਭਾਸ਼ਾਵਾਂ ਮਾੜੀ ਨੇ ਪਰ ਪੰਜਾਬ 'ਚ ਹੁੰਦਿਆਂ ਪੰਜਾਬੀ ਭਾਸ਼ਾ ਨੂੰ ਭੁਲਾ ਕੇ ਅਤੇ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਇਹ ਵੀ ਤਾਂ ਕੋਈ ਚੰਗੀ ਗੱਲ ਨਹੀਂ ਅਤੇ ਚੌਥੀ ਗੱਲ ਜਿਹੜੀ ਸਾਡੇ ਪੰਜਾਬ ਦੀ ਨਸ਼ਿਆਂ ਦੀ ਗੱਲ ਰਹੀ ਨਸ਼ੇ ਵੀ ਪੰਜਾਬ 'ਚ ਸੌਖੇ ਜਿਹੇ ਤਾਂ ਨਹੀਂ ਆਉਂਦੇ ਨਸ਼ੇ ਵੀ ਕਿੰਨੇ ਬੋਡਰ ਪਾਰ ਕਰਕੇ ਆਉਂਦੇ ਨੇ ਤਾਂ ਜੇ ਸਰਕਾਰ ਉਹਨਾਂ ਬੋਡਰਾਂ 'ਤੇ ਥੋੜ੍ਹੀ ਜਿਹੀ ਸਖਤਾਈ ਕਰੇ ਤਾਂ ਸ਼ਾਇਦ ਓਹ ਵੀ ਬੰਦ ਹੋ ਸਕਦੇ ਨੇ ਕੁਝ ਲੋਕ ਤਾਂ ਪੰਜਾਬ 'ਚ ਇਸ ਕਰਕੇ ਨਸ਼ੇ ਕਰਦੇ ਨੇ ਕਿਉਂਕਿ ਓਹਨਾਂ ਕੋਲ ਹੋਰ ਕੋਈ ਹਿੱਲਾ ਵਸੀਲਾ ਨਹੀਂ ਹੁੰਦਾ ਪੈਸੇ ਕਮਾਉਣ ਦਾ ਤਾਂ ਓਹ ਟੈਂਸ਼ਨ 'ਚ ਆ ਕੇ ਨਸ਼ੇ ਦੀ ਲਾਈਨ ਵਿੱਚ ਵੜ ਜਾਂਦੇ ਨੇ ਇਸ ਤਰੀਕੇ ਨਾਲ ਜੇ ਸਰਕਾਰ ਦੇਸ਼ ਦੇ ਲੋਕਾਂ ਦੀ ਮਦਦ ਕਰੇ ਓਹਨਾਂ ਨੂੰ ਨੌਕਰੀਆਂ ਦੇਵੇ ਐਜੂਕੇਸ਼ਨ ਸਿਸਟਮ ਵਧੀਆ ਕਰੇ ਲੋਕਾਂ ਦੀ ਆਪਣੀ ਸਰਕਾਰ ਬਣ ਕੇ ਰਹੇ ਤਾਂ ਦੇਸ਼ ਦਾ ਬਹੁਤ ਸੁਧਾਰ ਹੋ ਸਕਦਾ ਹੈ ਨਹੀਂ ਤਾਂ ਅੱਜ ਕੱਲ੍ਹ ਸਰਕਾਰਾਂ ਇੱਦਾਂ ਨਹੀਂ ਕਰਦੀਆਂ ਸਭ ਕੁਰਸੀ ਦੀ ਮਾਲਕ ਬਣਨਾ ਚਾਹੁੰਦੀ ਹੈ ਅਤੇ ਗਰੀਬਾਂ ਦਾ ਸਾਥ ਕੋਈ ਨਹੀਂ ਬਣਨਾ ਚਾਹੁੰਦਾ ਜੇ ਸਾਡੇ ਦੇਸ਼ ਦੀਆਂ ਸਰਕਾਰਾਂ ਗਰੀਬਾਂ ਦਾ ਸਾਥ ਬਣ ਜਾਣ ਅਤੇ ਲੋਕਾਂ ਦੀਆਂ ਮਦਦ ਕਰਨ ਵਾਲੀਆਂ ਬਣ ਜਾਣ ਤਾਂ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਬਹੁਤ ਸੁਧਾਰ ਹੋ ਸਕਦਾ ਹੈ ਅਤੇ ਪੰਜਾਬ ਪਹਿਲਾਂ ਵਾਂਗ ਹੀ ਸੋਨੇ ਦੀ ਚਿੜੀ ਅੱਜ ਵੀ ਬਣ ਸਕਦਾ ਹੈ